ਮੈਂ ਰਾਮਦਾਸ ਪਿੰਡ ਨਵਾਂ ਗਰਾਂ ਡਾਕਖਾਨਾ ਸੁਜਾਨਪੁਰ ਤਹਿਸੀਲ ਅਤੇ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਕਿ ਮੈਂ ਆਪਣੇ ਬਾਗ ਦੇ ਵਿੱਚ ਜਦੋਂ ਆਪਣੇ ਲਗਾਏ ਪੌਦਿਆਂ ਨੂੰ ਅਤੇ ਰੁੱਖਾਂ ਨੂੰ ਖਿੜਿਆ ਦੇਖਦਾ ਤਾਂ ਮੇਰਾ ਮਨ ਬੜਾ ਖੁਸ਼ ਹੁੰਦਾ ਇੱਕ ਖੁਸ਼ੀ ਹੋਣੀ ਵੀ ਲਾਜ਼ਮੀ ਹੈ ਕਿ ਇਹ ਪੌਦੇ ਅਤੇ ਰੁੱਖ ਹੀ ਜਿਹੜੇ ਨੇ ਧੀਆਂ ਪੁੱਤਰਾਂ ਵਾਂਗ ਹੁੰਦੇ ਹਨ ਜਿਸ ਤਰ੍ਹਾਂ ਇਨਸਾਨ ਆਪਣੇ ਧੀਆਂ ਪੁੱਤਰਾਂ ਨੂੰ ਦੇਖ ਕੇ ਖੁਸ਼ ਹੁੰਦਾ ਅਤੇ ਪੌਦੇ ਅਤੇ ਰੁੱਖ ਵੀ ਆਪਣੇ ਧੀਆਂ ਪੁੱਤਰਾਂ ਵਾਂਗ ਹੀ ਹੁੰਦੇ ਹਨ ਅਤੇ ਜਦੋਂ ਲਗਾਏ ਪੌਦਿਆ ਨੂੰ ਅਤੇ ਰੁੱਖਾਂ ਨੂੰ ਇਨਸਾਨ ਦੇਖਦਾ ਤਾਂ ਉਹਦੀ ਖੁਸ਼ੀ ਦੀ ਕੋਈ ਸੀਮਾ ਨਹੀ ਰਹਿੰਦੀ ਅਤੇ ਮੈਂ ਆਪਣੇ ਬਾਗ ਦੇ ਵਿੱਚ ਸਬਜ਼ੀਆਂ ਅਤੇ ਫਲਦਾਰ ਰੁੱਖ ਲਗਾਏ ਹੋਏ ਹਨ ਜਿਵੇਂ ਕਿ ਸਬਜ਼ੀਆਂ ਦੇ ਵਿੱਚ ਕਰੇਲਾ ਲੋਕੀ ਘੀਆ ਕੱਦੂ ਚੱਪਣ ਕੱਦੂ ਫ ਫਿਰ ਬੈਂਗਨ ਟਮਾਟਰ ਪਿਆਜ਼ ਲਸਣ ਹਲਦੀ ਆਦਿ ਵਗੈਰਾ ਸਬਜ਼ੀਆਂ ਲਗਾਈਆਂ ਹੋਈਆਂ ਹਨ ਅਤੇ ਜਦੋਂ ਉਹ ਲਗਾਉਣ ਤੋਂ ਬਾਅਦ ਜਦੋਂ ਉਹ ਪਹਿਲੀ ਵਾਰ ਫੁੱਟਦੇ ਨੇ ਜਾਂ ਜਮੀਨ ਤੋਂ ਬਾਹਰ ਆਉਂਦੇ ਨੇ ਮੇਰੀ ਖੁਸ਼ੀ ਦੀ ਕੋਈ ਸੀਮਾ ਨਹੀਂ ਹੁੰਦੀ ਮੈਨੂੰ ਇਹ ਹੀ ਲੱਗਦਾ ਕਿ ਮੈਂ ਜੋ ਬੀਜ਼ ਬੀਜ਼ਿਆ ਉਹ ਉਗ ਆਇਆ ਹੈ ਫਿਰ ਉਸਨੂੰ ਪਾਣੀ ਦੇ ਕੇ ਸਿੰਜਿਆ ਜਾਂਦਾ ਹੈ ਸਿੰਜਣ ਤੋਂ ਬਾਅਦ ਫਿਰ ਉਹਨਾਂ ਦੀ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ ਉਹਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਉਹ ਵੱਧ ਕੇ ਉਹਨਾਂ ਦਾ ਤੇ ਥੋੜ੍ਹੇ ਜਿਹੇ ਵੱਡੇ ਵੱਡੇ ਹੁੰਦੇ ਹਨ ਤਾਂ ਫਿਰ ਮੇਰੀ ਖੁਸ਼ੀ ਦੀ ਬਹੁਤ ਕੋਈ ਸੀਮਾ ਨਹੀਂ ਰਹਿੰਦੀ ਫਿਰ ਜਦੋਂ ਫਲ ਲੱਗਦਾ ਹੈ ਉਹਨਾਂ ਨੂੰ ਪਹਿਲਾ ਫਲ ਲੱਗਦਾ ਹੈ ਤਾਂ ਮੈਂ ਬੜਾ ਖੁਸ਼ ਹੁੰਦਾ ਕਿ ਮੇਰੀ ਬੀਜ਼ੀ ਸਬਜ਼ੀ ਜਾਂ ਮੇਰੇ ਬੀਜ਼ੇ ਰੁੱਖਾਂ ਤੋਂ ਫਲ ਮੈਂ ਪ੍ਰਾਪਤ ਕੀਤਾ ਹੈ ਉਹ ਭਾਵੇਂ ਕਿ ਜਿੰਨੇ ਕੁ ਪੈਸੇ ਖਰਚੇ ਹੁੰਦੇ ਉਹਨਾਂ ਕੋਲੋਂ ਪਹਿਲਾ ਫਲ ਬੜਾ ਘੱਟ ਹੁੰਦਾ ਹੈ ਪਰ ਫਿਰ ਵੀ ਮੇਰੀ ਮੈਨੂੰ ਇੰਨਾ ਹੁੰਦਾ ਕਿ ਮੈਂ ਆਪਣੀ ਬੀਜ਼ੀ ਚੀਜ਼ ਤੋਂ ਬੀਜ਼ੀ ਚੀਜ਼ ਤੋਂ ਬੀਜ਼ੇ ਪੌਦੇ ਤੋਂ ਬੀਜ਼ੇ ਰੁੱਖ ਤੋਂ ਮੈਂ ਕੁਛ ਪ੍ਰਾਪਤ ਕੀਤਾ ਹੈ ਪਰ ਬਹੁਤ ਵਧੀਆ ਪ੍ਰਾਪਤ ਕੀਤਾ